ਪੰਜਾਬੀ ਲੋਕ ਆਪਣੀ ਭਾਸ਼ਾ ਦੀ ਵਰਤੋਂ ਬਹੁਤ ਪਿਆਰ ਅਤੇ ਮੁਹੱਬਤ ਨਾਲ ਕਰਦੇ ਹਨ ਪੰਜਾਬੀ ਇਸ ਗੱਲੋਂ ਵੀ ਜਾਣੇ ਜਾਂਦੇ ਹਨ ਕਿ ਉਹਨਾਂ ਦੀ ਜੋ ਭਾਸ਼ਾ ਹੈ ਬਹੁਤ ਮਿੱਠੀ ਅਤੇ ਬਹੁਤ ਪਿਆਰੀ ਹੈ ਜਿਸ ਨਾਲ ਵੀ ਇਹ ਬੋਲਦੇ ਹਨ ਆਪਣੇ ਪੂਰੇ ਪ੍ਰੋਪਰ ਐਨ ਪਿਆਰ ਨਾਲ ਬੋਲਦੇ ਕਹਿੰਦੇ ਵੀ ਜਿਸ ਨਾਲ ਦੂਜੇ ਬੰਦੇ ਨੂੰ ਗੱਲਬਾਤ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਅਤੇ ਆਪਾਂ ਜੇ ਗੱਲ ਕਰੀਏ ਅੱਜ ਕਲ੍ਹ ਪੰਜਾਬੀ ਇੰਨੀ ਕੁ ਆਪਣੀ ਮਸ਼ਹੂਰ ਹੈ ਕਿ ਅੱਜ ਕਲ੍ਹ ਐਸੀ ਕੋਈ ਸਟੇਟ ਕੋਈ ਜਗ੍ਹਾ ਨਹੀਂ ਹੈਗੀ ਜਿੱਥੇ ਪੰਜਾਬੀ ਨਾ ਹੋਵੇ ਅਤੇ ਪੰਜਾਬੀ ਨਾ ਬੋਲੀ ਜਾਂਦੀ ਹੋਵੇ ਪੰਜਾਬੀ ਪੰਜਾਬੀ ਮਾਂ ਬੋਲੀ ਜਿਉਂ ਜਿਉਂ ਪੰਜਾਬੀ ਦੇ ਵਿੱਚ ਆਪਾਂ ਕਿਸੇ ਨਾਲ ਵੀ ਗੱਲਬਾਤ ਕਰਦੇ ਹਾਂ ਤਾਂ ਜੋ ਆਪਣਾ ਪਰਸਨ ਆ ਉਹ ਆਪਾਂ ਨੂੰ ਅੰਡਰਸਟੈਂਡ ਕਰਦਾ ਕਿਉਂਕਿ ਅੱਜ ਕਲ੍ਹ ਪੰਜਾਬੀ ਹਰ ਜਗ੍ਹਾ ਪਾਏ ਜਾਂਦੇ ਆ ਅਤੇ ਪੰਜਾਬੀ ਜਦੋਂ ਵੀ ਗੱਲਬਾਤ ਕਰਦਾ ਤਾਂ ਆਪਾਂ ਆਪਣੇ ਪੂਰੇ ਪ੍ਰੋਪਰ ਤਰੀਕੇ ਨਾਲ ਕਰਦਾ ਵੀ ਹਾਂ ਅਗਲਾ ਉਸ ਦੀ ਗੱਲ ਨੂੰ ਅੰਡਰਸਟੈਂਡ ਕਰੇ ਅਤੇ ਅੱਜ ਕਲ੍ਹ ਕੋਈ ਵੀ ਨਹੀਂ ਹੋਊਗਾ ਜੋ ਪੰਜਾਬੀ ਨੂੰ ਨਾ ਸਮਝਦਾ ਹੋਵੇ ਅਤੇ ਪੰਜਾਬੀ ਹੀ ਹੁੰਦੀ ਹੈ ਅਤੇ ਅੱਜ ਕਲ੍ਹ ਪੰਜਾਬੀ ਸਾਰੇ ਕਿਤੇ ਵੱਸਦੇ ਹੈ ਕੈਨੇਡਾ ਅਮਰੀਕਾ ਕਿਸੇ ਵੀ ਕੰਟਰੀ ਚੱਲ ਜਾਓ ਸਾਰੇ ਕਿਤੇ ਪੰਜਾਬੀ ਆ ਅਤੇ ਜਿਸ ਕਾਰਨ ਵੀ ਕੋਈ ਨਹੀਂ ਇੱਦਾਂ ਦਾ ਪਰਸਨ ਹੋਉਗਾ ਜੋ ਪੰਜਾਬੀ ਅੰਡਰਸਟੈਂਡ ਨਹੀਂ ਕਰਦਾ ਹੋਣਾ ਜਿਸ ਵਿੱਚ ਪੰਜਾਬੀ ਬੋਲਣ ਵਿੱਚ ਅਤੇ ਸਮਝਣ ਵਿੱਚ ਕਿਸੇ ਨੂੰ ਜ਼ਿਆਦਾ ਮੁਸ਼ਕਿਲ ਨਹੀਂ ਆਉਂਦੀ ਇਸ ਕਰਕੇ ਪੰਜਾਬੀ ਸਾਰੇ ਕਿਤੇ ਬੋਲੀ ਜਾਂਦੀ ਆ ਅਤੇ ਸਭ ਨੂੰ ਪਿਆਰ ਨਾਲ ਬੋਲੀ ਸਭ ਨਾਲ ਪਿਆਰ ਨਾਲ ਗੱਲ ਕਰਦੇ ਹਾਂ ਅਤੇ ਦਿੱਕਤ ਕਿਸੇ ਨੂੰ ਨਹੀਂ ਆਉਂਦੀ ਕਿਉਂਕਿ ਹੁਣ ਪੰਜਾਬੀ ਸਾਰੇ ਪਾਸੇ ਹੈਗੇ ਆ ਤਾਂ ਸਾਰਿਆਂ ਨਾਲ ਗੱਲਬਾਤ ਹੋ ਜਾਂਦੀ ਹੈ ਅਤੇ ਸਾਰੇ ਜਾਣੇ ਸਮਝ ਜਾਂਦੇ ਹਨ ਗੱਲਾਂ ਨੂੰ